ਵੱਕ ਵੱਖ ਮੌਸਮ ਸਥਿਤੀਆਂ ਵਿੱਚ ਜਿਵੇਂ ਕਿ ਗਰਮੀ ਅਤੇ ਠੰਡ ਵਿੱਚ ਦੌੜਨ ਲਈ ਵੱਖ ਵੱਖ ਸੁਝਾਅ ਦਿੱਤੇ ਜਾਂਦੇ ਹਨ ਅਤੇ ਨੈੱਟਾਂ 'ਤੇ ਯੂਟੀਊਬਾਂ ਉੱਤੇ ਸਭ ਕੁਝ ਹੀ ਦਿੱਤਾ ਹੁੰਦਾ ਪਰ ਮੈਂ ਇੱਕ ਆਪਣੇ ਵੱਲੋਂ ਸੁਝਾਅ ਇਹ ਦਿੱਤਾ ਜਾਂਦਾ ਹੈ ਕਿ ਜਿਵੇਂ ਕਿ ਮੈਂ ਗਰਮੀ ਵਿੱਚ ਆਪਣੀ ਰਨਿੰਗ ਕਰਨ ਲਈ ਜਾਂਦਾ ਹਾਂ ਤਾਂ ਇੱਦਾਂ ਮਹਿਸੂਸ ਹੁੰਦਾ ਕਿ ਗਰਮੀ ਬਹੁਤ ਜ਼ਿਆਦਾ ਪਰ ਨਹੀਂ ਇੱਦਾਂ ਕੁਛ ਨਹੀਂ ਹੁੰਦਾ ਇਸ ਨਾਲ ਤਾਂ ਸਾਡੇ ਦੀ ਗਰਮਾਇਸ਼ ਬਹੁਤ ਜਲਦੀ ਨਿਕਲਦੀ ਹੈ ਅਤੇ ਗਰਮੀਆਂ ਵਿੱਚ ਸਭ ਤੋਂ ਚੰਗਾ ਸਮਾਂ ਦੌੜਨ ਲਈ ਸਵੇਰੇ ਹੈ ਸਵੇਰੇ ਅਸੀਂ ਚਾਰ ਵਜੇ ਤੋਂ ਲੈ ਕੇ ਉਸ ਤੋਂ ਬਾਅਦ ਜਿੰਨੇ ਵੀ ਮਰਜ਼ੀ ਵਜੇ ਤੱਕ ਦੌੜ ਸਕਦੇ ਹਾਂ ਜਿੰਨਾਂ ਚਿਰ ਧੁੱਪ ਨਹੀਂ ਨਿਕਲਦੀ ਇਸੇ ਨਾਲ ਸਾਡੀ ਸਿਹਤ 'ਤੇ ਸਿਹਤ 'ਤੇ ਬਹੁਤ ਅਸਰ ਨਹੀਂ ਪੈਂਦਾ ਜਿਸ ਨਾਲ ਅਸੀਂ ਬਹੁਤ ਹੀ ਤੰਦਰੁਸਤ ਮਹਿਸੂਸ ਕਰਦੇ ਹਾਂ ਗਰਮੀਆਂ ਵਿੱਚ ਦੌੜਨ ਤੋਂ ਜ਼ਿਆਦਾ ਅੱਛਾ ਹੈ ਅਸੀਂ ਡਰਾਈ ਫਰੂਟ ਲੈ ਸਕਦੇ ਹਾਂ ਜੂਸ ਪੀ ਸਕਦੇ ਹਾਂ ਜਿਸ ਨਾਲ ਸਾਨੂੰ ਗਰਮੀ ਨਹੀਂ ਲੱਗ ਸਕਦੀ ਸਰਦੀਆਂ ਵਿੱਚ ਦੌੜਨਾ ਤਾਂ ਹੋਰ ਵੀ ਸਿਹਤਮੰਦ ਹੈ ਇਸ ਨਾਲ ਸਾਡੇ ਸਰੀਰ ਦੀ ਗਰਮੀ ਨਿਕਲਦੀ ਹੈ ਸਾਨੂੰ ਠੰਡ ਘੱਟ ਲੱਗਦੀ ਆ ਅਤੇ ਅਸੀਂ ਮੋਟੇ ਨਹੀਂ ਹੁੰਦੇ ਮੋਟਿਆਂ ਲਈ ਦੌੜਨਾ ਬਹੁਤ ਸਿਹਤ ਲਈ ਚੰਗਾ ਹੈ ਤਾਂ ਉਹ ਦੌੜ ਕੇ ਆਪਣੇ ਕਸਰਤਾਂ ਕਰ ਸਕਦੇ ਹਨ ਅਤੇ ਉਹ ਮੋਟਾਪਾ ਦੂਰ ਕਰ ਸਕਦੇ ਹਨ ਦੌੜਨ ਨਾਲ ਸਾਡਾ ਸਰੀਰ ਫਿਟ ਰਹਿੰਦਾ ਹੈ ਜਿਸ ਨਾਲ ਸਾਨੂੰ ਬਿਮਾਰੀਆਂ ਨਹੀਂ ਲੱਗਦੀਆਂ ਹਨ ਅਤੇ ਜੇਕਰ ਅਸੀਂ ਨਹੀਂ ਦੌੜਦੇ ਤਾਂ ਸਾਨੂੰ ਬਿਮਾਰੀਆਂ ਲੱਗਣੀਆਂ ਜਿਸ ਨਾਲ ਸਾ ਸਾਨੂੰ ਦਵਾਈਆਂ ਵਗੈਰਾ ਲੈਣੀਆਂ ਪੈਣਗੀਆਂ ਅਤੇ ਜਿਸ ਨਾਲ ਅਸੀਂ ਇੱਕ ਕੰਮ ਵੀ ਨਹੀਂ ਕਰ ਸਕਦੇ ਸਾਨੂੰ ਆਪਣਾ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਅਤੇ ਸੁਬਾਹ ਉੱਠ ਕੇ ਦੌੜਨਾ ਚਾਹੀਦਾ ਹੈ ਤਾਂ ਜੋ ਅਸੀਂ ਸਿਹਤਮੰਦ ਰਹਿ ਸਕੀਏ ਅਤੇ ਅਸੀਂ ਦੌੜਨ ਨਾਲ ਅਸੀਂ ਬਹੁਤ ਚੰਗਾ ਪਰਫੋਰਮੰਸ ਦੇ ਸਕਦੇ ਹਾਂ ਇਸ ਨਾਲ ਅਸੀਂ ਖੇਡਾਂ ਵਿੱਚ ਹਿੱਸਾ ਲੇ ਸਕਦੇ ਹਾ ਜਿਵੇਂ ਕਿ ਅਥਲੈਟਿਕ ਮੀਟਸ ਹੁੰਦੀ ਹੈ ਉਸ ਵਿੱਚ ਦੌੜਨਾ ਅਤੇ ਬਹੁਤ ਹੀ ਸਹੂਲਤ ਅਤੇ ਮੈਡਲ ਪ੍ਰਦਾਨ ਕੀਤੇ ਜਾਂਦੇ ਹਨ ਇਸ ਨਾਲ ਅਸੀਂ ਦੌੜ ਕੇ ਆਪਣੇ ਪੇਟ ਦੀਆਂ ਕਸਰਤਾਂ ਕਰ ਸਕਦੇ ਹਾਂ ਅਸੀਂ ਆਪਣੀ ਸਪੀਡ ਵਿੱਚ ਵਰਕਆਊਟ ਕਰ ਸਕਦੇ ਹਾਂ ਅਸੀਂ ਆਪਣਾ ਨਾਮ ਬਣਾ ਸਕਦੇ ਹਾਂ ਖੇਡਾਂ ਵਿੱਚ ਨਾਮ ਬਣਾ ਸਕਦਾ ਦੌੜਾਂ ਵਿੱਚ ਨਾਮ ਬਣਾ ਸਕਦੇ ਹਾਂ ਦੌੜਣ ਨਾਲ ਸਾਡੀ ਕਸਰਤ ਬਹੁਤ ਵਧੀਆ ਹੁੰਦੀ ਹੈ